ਹਾਂਜੀ ਹੈਲੋ ਹਾਂਜੀ ਜਗਦੀਸ਼ ਸਿੰਘ ਬੋਲਦਾ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੁਸੀਂ ਕੌਣ ਠੀਕ ਹੈ ਜੀ ਕੀ ਨਾਮ ਹੈ ਆਪਣਾ ਸ ਠੀ ਠੀਕ ਹੈ ਠੀਕ ਹੈ ਹਾਂਜੀ ਦੱਸੋ ਜੀ ਠੀਕ ਹੈ ਜੀ ਜ਼ਰੂਰ ਸਾਡੇ ਜ਼ਿਲ੍ਹੇ ਵਿੱਚ ਇੱਕ ਤਾਂ ਜਿਹੜਾ ਸ਼ਹੀਦ ਭਗਤ ਸਿੰਘ ਦਾ ਜਿਹੜਾ ਪਿੰਡ ਹੈਗਾ ਆ ਖਟਕੜ ਕਲਾਂ ਉਹਨਾਂ ਦੀ ਸਮਾਰਕ ਹਾਂਜੀ ਸਮਾਰਕ ਉਹਨਾਂ ਦੀ ਉੱਥੇ ਉਹ ਬਹੁਤ ਵਧੀਆ ਬਣੀ ਹੋਈ ਆ ਅਤੇ ਬਹੁਤ ਯਾਦਗਾਰੀ ਜਾਣੀ ਕਿ ਇੱਕ ਬਹੁਤ ਲੰਬਾ ਸਟੈਚੂ ਵੀ ਉਹਨਾਂ ਦਾ ਬਣਾਇਆ ਹੋਇਆ ਆ ਅਤੇ ਇੱਕ ਲਾਈਬ੍ਰੇਰੀ ਵੀ ਬਹੁਤ ਵਧੀਆ ਬਣਾਈ ਹੋਈ ਆ ਅਤੇ ਹਾਂਜੀ ਹਾਂਜੀ ਉਹਨਾਂ ਦਾ ਜਿਹੜਾ ਜੱਦੀ ਘਰ ਹੈਗਾ ਖਟਕੜ ਕਲਾਂ ਪਿੰਡ ਦੇ ਵਿੱਚ ਉਹ ਬਹੁਤ ਸੋਹਣੇ ਤਰੀਕੇ ਨਾਲ ਸਾਂਭਿਆ ਹੋਇਆ ਅਤੇ ਉੱਥੇ ਦੀਆਂ ਖਾਸਕਰ ਖਟਕੜ ਕਲਾਂ ਦਾ ਜਿਹੜਾ ਪਾਰਕ ਹੈ ਉਹ ਬਹੁਤ ਸੋਹਣਾ ਆ ਅਤੇ ਡਿਵੈਲਪਮੈਂਟ ਪਿੰਡ ਦੀ ਬਹੁਤ ਸੋਹਣੀ ਕੀਤੀ ਹੋਈ ਆ ਨਾਲ ਦੀ ਨਾਲ ਜਿਹੜਾ ਹਾਂਜੀ ਹਾਂਜੀ ਹਾਂਜੀ ਨਵਾਂਸ਼ਹਿਰ ਸ਼ਹਿਰ ਦੇ ਵਿੱਚ ਵੀ ਫਲਾਈਓਵਰ ਤਿਆਰ ਹੋ ਰਿਹਾ ਆ ਅਤੇ ਉੱਥੇ ਦੇ ਨਵਾਂਸ਼ਹਿਰ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਹੈ ਬਹੁਤ ਵਧੀਆ ਤਰੀਕੇ ਨਾਲ ਹੁਣ ਬਣਾਇਆ ਗਿਆ ਆ ਅਤੇ ਹੋਰ ਪਿੰਡਾਂ ਦੇ ਵਿੱਚ ਵੀ ਉੱਥੇ ਬਹੁਤ ਸੋਹਣਾ ਜੋ ਸੜਕਾਂ ਦਾ ਕੰਮ ਚੱਲ ਰਿਹਾ ਆ ਅਤੇ ਖਾਸਕਰ ਛੋਟੇ ਪਿੰਡਾਂ ਦੇ ਵਿੱਚ ਵੀ ਸੀਵਰੇਜ ਹੁਣ ਪੈ ਰਿਹਾ ਆ ਅਤੇ ਨਾਲ ਦੀ ਨਾਲ ਜਿਹੜੀਆਂ ਪਿੰਡ ਦੀਆਂ ਗਲੀਆਂ ਪਹਿਲਾਂ ਇੱਟਾਂ ਦੀਆਂ ਹੁੰਦੀਆਂ ਸੀ ਅਤੇ ਹੁਣ ਉੱਥੇ ਇੰਟਰਲੋਕ ਨਾਲ ਜਿਹੜੀਆਂ ਗਲੀਆਂ ਤਿਆਰ ਕੀਤੀਆਂ ਜਾ ਰਹੀਆਂ ਆ ਅਤੇ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਇੱਕ ਪਿੰਡ ਹੈਗਾ ਜੀ ਜ਼ਿਲ੍ਹਾ ਜਿਹੜੇ ਮੇਰੇ ਨੌਲੇਜ ਵਿੱਚ ਹੈਗਾ ਆ ਵੈਸੇ ਤਾਂ ਕਾਫੀ ਪਿੰਡ ਹੈ ਪਿੰਡ ਮਾਣੇਵਾਲ ਬਹੁਤ ਸੋਹਣਾ ਬਣਾਇਆ ਗਿਆ ਬਹੁਤ ਵਧੀਆ ਪਾਰਕ ਬਣਾਇਆ ਗਿਆ ਅਤੇ ਬਹੁਤ ਵਧੀਆ ਉੱਥੇ ਪਿੰਡ ਵਿੱਚ ਰਾਤ ਦੀਆਂ ਲਾਈਟਾਂ ਲਗਾਈਆਂ ਗਈਆਂ ਰਾਤ ਲਈ ਅਤੇ ਬਹੁਤ ਵਧੀਆ ਪਿੰਡ ਬਣਾਇਆ ਜੀ ਹਾਂਜੀ ਹਾਂਜੀ ਤੁਸੀਂ ਤੁਸੀਂ ਕਦੋਂ ਆ ਰਹੇ ਆਂ ਕਦੋਂ ਆ ਰਹੇ ਆਂ ਜੀ ਓਕ ਧੰਨਵਾਦ ਓ ਓਕੇ ਓ ਓਕੇ ਧੰਨਵਾਦ